ਅਸੀਂ ਫ਼ਸਲਾਂ ਤੋਂ ਪਸ਼ੂਆਂ ਦੀ ਰਾਖੀ ਆਲੇ ਦੁਆਲੇ ਵਾੜ ਬਣਾ ਕੇ ਕਰ ਸਕਦੇ ਹਾਂ ਜਾਂ ਖੇਤ ਵਿੱਚ ਰਹਿ ਕੇ ਆਪਾਂ ਰਾਤ ਨੂੰ ਕਰ ਸਕਦੇ ਹਾਂ ਜਾਂ ਡਰਾਉਣ ਵਗੈਰਾ ਰਾਤ ਨੂੰ ਬਣਾ ਡਰਾਉਣ ਵਗੈਰਾ ਬਣਾ ਕੇ ਜਿਵੇਂ ਆਪਣਾ ਪੁਤਲਾ ਬਣਾ ਲਿਆ ਕਿਸੇ ਚੀਜ਼ ਦਾ ਉਹ 'ਚ ਡੰਡਾ ਪਾ ਦਿੰਦੇ ਹਾਂ ਵਿੱਚ ਪਰਾਲੀ ਪਾ ਦਿੰਦੇ ਹਾਂ ਇੱਦਾਂ ਵਾ ਜਿਸ ਤਰ੍ਹਾਂ ਇੱਦਾਂ ਅਹਿਸਾਸ ਹੋਵੇ ਜਾਨਵਰਾਂ ਨੂੰ ਕਿ ਕੋਈ ਬੰਦਾ ਖੜ੍ਹਾਂ ਦੂਰੋਂ ਉਹਨੂੰ ਅਹਿਸਾਸ ਹੋਵੇ ਕਿ ਬੰਦਾ ਖੜ੍ਹਾਂ ਕੋਈ ਮੈਨੂੰ ਮਾਰੂਗਾ ਹੁਣ ਅਤੇ ਉੱਦੋਂ ਬਾਅਦ ਅਸੀਂ ਆਲੇ ਦੁਆਲੇ ਰੀਲ ਹੁੰਦੀ ਹੈ ਕੈਸਟਾਂ ਵਾਲੀ ਉਹ ਬੰਨ ਸਕਦੇ ਹਾਂ ਜਾਂ ਰਾਤ ਨੂੰ ਆਪਣੇ ਰਾਤ ਨੂੰ ਰਾਖੀ ਖੁਦ ਕਰ ਸਕਦੇ ਉੱਥੇ ਲੈਟ ਵਗੈਰਾ ਲਗਾ ਕੇ ਇੱਦਾਂ ਆਪਾਂ ਰਾਖੀ ਉਹਨਾਂ ਦੀ ਕਰ ਸਕਦੇ ਹਾਂ ਨੁਕਸਾਨ ਆਪਾਂ ਨੂੰ ਨੀਲ ਗਾਏ ਅਤੇ ਗਾਵਾਂ ਬਹੁਤ ਪਹੁੰਚਾਉਂਦੀਆਂ ਹਨ ਅਤੇ ਇਹ ਸਾਰੀ ਫ਼ਸਲ ਖਾ ਜਾਂਦੀਆਂ ਅਤੇ ਸਾਰੀ ਮਿਧ ਦਿੰਦੀਆਂ ਤਾਂ ਜੋ ਫ਼ਸਲ ਆਪਣੀ ਅੱਗੇ ਇੱਕ ਤਾਂ ਖਾਣਾ ਖਾ ਜਾਂਦੀਆਂ ਉਹ ਉੱਦੋਂ ਬਾਅਦ ਫ਼ਸਲ ਆਪਣੀ ਅੱਗੇ ਨਹੀਂ ਹੁੰਦੀ ਉਹ ਫ਼ਸਲ ਉੱਥੇ ਹੀ ਖ਼ਤਮ ਹੋ ਜਾਂਦੀ ਹੈ ਜਿਸ ਨਾਲ ਆਪਣਾ ਆਰਥਿਕ ਨਕਸਾਨ ਬਹੁਤ ਹੁੰਦਾ ਹੈ ਅਤੇ ਸਿਰਫ਼ ਆਪਾਂ ਇੱਦਾਂ ਹੀ ਜਾਨਵਰ ਇਹ ਨੁਕਸਾਨ ਬਹੁਤ ਜ਼ਿਆਦਾ ਕਰਦੇ ਜਿੱਦਾਂ ਚੂਹਾ ਹੋਇਆ ਚੂਹਾ ਆਪਣੀ ਫ਼ਸਲ ਕੱਟ ਦਿੰਦਾ ਸਾਰੀ ਥੱਲੋਂ ਹੌਲੀ ਹੌਲੀ ਕੱਟਦਾ ਰਹਿੰਦਾ ਉਹਨਾਂ ਨੂੰ ਆਪਾਂ ਦਵਾਈ ਪਾ ਕੇ ਅਤੇ ਤਾਂ ਇੱਦਾਂ ਬਚਾ ਸਕਦੇ ਹਾਂ ਤਾਂ ਜੋ ਆਪਣੀਆਂ ਫਸਲਾਂ ਬਚੀਆਂ ਰਹਿਣ ਅਤੇ ਨੀਲ ਗਾਏ ਤੋਂ ਵੀ ਨੀਲ ਗਾਏ ਵੀ ਆਪਣਾ ਅਤੇ